ਭਾਰਤ ਦੇ ਵੱਖ ਵੱਖ ਥਾਵਾਂ ਦੀ ਖਾਣੇ ਦੀ ਮੈਨੂੰ ਕੋਈ ਖ਼ਾਸ ਜਾਣਕਾਰੀ ਨਹੀਂ ਹੈ ਪਰ ਅਸੀਂ ਜ਼ਿਆਦਾਤਰ ਉਹੀ ਖਾਣਾ ਬਣਾਉਂਦੇ ਹਾਂ ਜੋ ਅਸੀਂ ਆਪਣੇ ਘਰ ਦੀਆਂ ਇਸਤਰੀਆਂ ਤੋਂ ਸਿੱਖਿਆ ਹੁੰਦਾ ਹੈ ਪਰ ਜੇ ਸਾਡਾ ਕੁਛ ਨਵਾਂ ਖਾਣ ਦਾ ਦਿਲ ਹੁੰਦਾ ਹੈ ਤਾਂ ਮੈਂ ਯੂਟਿਊਬ 'ਤੇ ਸਰਚ ਕਰਦੀ ਹਾਂ ਅਤੇ ਜਿਵੇਂ ਦੀ ਰੈਸਪੀ ਉਹ ਦੱਸਦੇ ਹਨ ਮੈਂ ਉਹ ਬਣਾ ਲੈਂਦੀ ਹਾਂ ਅਤੇ ਸਿੱਖ ਲੈਂਦੀ ਹਾਂ